ਪੰਜਾਬ ਵਿੱਚ ਕੱਪੜਿਆਂ ਦੀ ਬੁਣਾਈ ਸਿਲਾਈ ਅਤੇ ਡਿਜਾਇਨਿੰਗ ਨਾਲ ਜੁੜੀਆਂ ਕਈ ਪਾਂ ਪਾਂਪ੍ਰਿਕ ਤਕਨੀਕਾਂ ਹਨ ਤਕਨੀਕਾਂ ਹਨ ਕੁਛ ਵਿਸ਼ੇਸ਼ ਤਕਨੀਕਾਂ ਅਤੇ ਪੈਟਰਨ ਹੇਠ ਪੰਜਾਬ ਦੀਆਂ ਸਭ ਤੋਂ ਪ੍ਰਸਿੱਧ ਕਢਾਈ ਤਕਨੀਕ ਹੈ ਇਹ ਹੱਥ ਨਾਲ ਕੀਤੀ ਜਾਂਦੀ ਹੈ ਜਿਸ ਵਿੱਚ ਰੰਗ ਬਿਰੰਗੇ ਧਾਗਿਆਂ ਨਾਲ ਕੱਪੜੇ 'ਤੇ ਡਿਜ਼ਾਇਨ ਬਣਾਈ ਜਾਂਦੀ ਹੈ ਵਿਅਕਤੀਗਤ ਵਰਤੋਂ ਲਈ ਦੁਪੱਟੇ ਸੂਟ ਅਤੇ ਚੁੰਨੀ 'ਤੇ ਇਹ ਕਢਾਈ ਕੀਤੀ ਜਾਂਦੀ ਹੈ ਬਾਗ ਫੁਲਕਾਰੀ ਇਹ ਫੁਲਕਾਰੀ ਦਾ ਇੱਕ ਉੱਤਮ ਰੂਪ ਹੈ ਜਿਸ ਵਿੱਚ ਪੂਰੇ ਕੱਪੜੇ ਨੂੰ ਬੁਣਾਈ ਨਾਲ ਕਵਰ ਕੀ ਕਰ ਦਿੱਤਾ ਜਾਂਦਾ ਹੈ ਇਹ ਜ਼ਿਆਦਾਤਰ ਵਿਆਹ ਜਾਂ ਵਧਾਈ 'ਚ ਵੱਜੋਂ ਵਰਤੀ ਜਾਂਦੀ ਹੈ ਵਰਕ ਕਢਾਈ ਇਹ ਸਾਰੀ ਸ਼ੈਲੀ ਦੀ ਕਢਾਈ ਹੁੰਦੀ ਹੈ ਜਿਸ ਵਿੱਚ ਸੋਨੇ ਜਾਂ ਚਾਂਦੀ ਦੇ ਧਾਗਿਆਂ ਨਾਲ ਡਿਜ਼ਾਇਨ ਬਣਾਈ ਜਾਂਦੀ ਹੈ ਇਹ ਨਵੀਂ ਦੌਰ ਵਿੱਚ ਲਹਿੰਗੇ ਸ਼ਰਾਰੇ ਅਤੇ ਵਿਆਹ ਵਾਲੇ ਕੱਪੜਿਆਂ 'ਚ ਵਰਤੀ ਜਾਂਦੀ ਹੈ ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਸ਼ਹਿਰ ਤੋਂ ਆਈ ਇੱਕ ਵਿਅਕਤੀ ਡਿਜ਼ਾਇਨ ਹੈ ਇਹ ਲੂਜ ਅਤੇ ਕੰਫਰਟੇਬਲ ਹੁੰਦੀ ਹੈ ਅਤੇ ਪਿੱਛੇ ਭਾਰੀਆਂ ਪਲੇ ਪਲੇਟਾਂ ਹੁੰਦੀਆਂ ਹਨ ਅੱਜ ਕੱਲ੍ਹ ਇਹ ਫੈਸ਼ਨ 'ਚ ਕਾਫੀ ਪ੍ਰਸਿੱਧ ਹੈ ਇਹ ਪੰਜਾਬ ਦੀ ਪੁਰਾਣੀ ਤਕਨੀਕ ਹੈ ਜਿਸ ਤਕਨੀਕ ਹੈ ਜਿਸ ਵਿੱਚ ਹੱਥ ਨਾਲ ਲੰਬੇ ਮੋਟੇ ਅਤੇ ਗਰਮ ਕੱਪੜੇ ਤਿਆਰ ਕੀਤੇ ਜਾਂਦੇ ਹਨ ਖੇਸ ਜ਼ਿਆਦਾਤਰ ਮਾਲ ਦਰੀਆਂ ਅਤੇ ਗਰਮ ਕੱਪੜੇ ਵ ਵਾਸਤੇ ਵਰਤੇ ਜਾਂਦੇ ਹਨ ਚੂੜੀਦਾਰ ਅਤੇ ਜੁੱਟੀਆਂ ਪੰਜਾਬ ਦੀ ਦਸਤਾਕਾਰ ਵਿੱਚ ਹੱਥ ਨਾਲ ਬਣੀਆਂ ਚਮੜੇ ਦੀਆਂ ਜੁੱਟੀਆਂ ਅਤੇ ਚੂੜੀਦਾਰ ਪਜਾਮੇ ਵੀ ਪ੍ਰਸਿੱਧ ਹਨ ਜੁੱਤੀਆਂ ਉੱਤੇ ਹੱਥ ਨਾਲ ਕਢਾਈ ਕੀਤੀ ਜਾਂਦੀ ਹੈ ਵਿਨਾਏ ਇਹ ਇੱਕ ਵਿਸ਼ੇਸ਼ ਤਕਨੀਕ ਹੈ ਜਿਸ ਵਿੱਚ ਕੱਪੜਿਆਂ ਉੱਤੇ ਪਤਲੇ ਧਾਗਿਆਂ ਨਾਲ ਛੋਟੀਆਂ ਛੋਟੀਆਂ ਨਿੱਘਾ ਬਣਾਈਆਂ ਜਾਂਦੀਆਂ ਹਨ ਪਿੰਡਾਂ ਵਿੱਚ ਤਕਨੀਕ ਨੂੰ ਪਿਛਲੇ ਜ਼ਮਾਨੇ ਵਿੱਚ ਔਰਤਾਂ ਆਪਣੇ ਕੱਪੜਿਆਂ ਨੂੰ ਸੁੰਦਰ ਬਣਾਉਣ ਲਈ ਵਰਤੀ ਵਰਤਦੀਆਂ ਸਨ ਧੰਨਵਾਦ